ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਹੈ ਕਿ ਪੇਂਟਿੰਗ ਕਰਨਾ ਮੇਰੀ ਹੋਬੀ ਹੈ ਇਸੇ ਤਰ੍ਹਾਂ ਪੇਂਟਿੰਗ ਮੈਂ ਮਤਲਬ ਸ਼ੁਰੂ ਸ਼ੁਰੂ ਵਿੱਚ ਜਦੋਂ ਸਿੱਖੀ ਸੀਗੀ ਤਦ ਮੈਂ ਡਰਾਇੰਗ ਕਾਪੀ 'ਤੇ ਡਰਾਇੰਗ ਕਾਪੀ ਜੋ ਡਰਾਇੰਗ ਸ਼ੀਟਾਂ ਆਉਂਦੀਆਂ ਸੀਗੀਆਂ ਪਹਿਲਾਂ ਪਹਿਲਾਂ ਸ਼ੁਰੂ ਕੀਤੀ ਸੀਗੀ ਜਦੋਂ ਮੈਂ ਤਾਂ ਮੈਂ ਡਰਾਇੰਗ ਆਪਣੀ ਪੇਂਟਿੰਗ ਜੋ ਪੇਂਟ ਹੈ ਉਹ ਪਹਿਲਾਂ ਪਹਿਲਾਂ ਸ਼ੁਰੂ ਵਿੱਚ ਸਿੱਖਣ ਦੇ ਲਈ ਮੈਂ ਉਹਨਾਂ ਨੂੰ ਪੇਂਟਿੰਗ ਨੂੰ ਆਪਣੇ ਉਹਦੇ ਉੱਤੇ ਹੀ ਕਰਦੀ ਹੁੰਦੀ ਸੀ ਜਿਸ ਨੂੰ ਆਪਾਂ ਸ਼ੀਟ ਕਹਿ ਦਿੰਦੇ ਹਾਂ ਜਿਵੇਂ ਕਿ ਛੋਟੇ ਬੱਚਿਆਂ ਦੀਆਂ ਪੇਂਟਿੰਗ ਵਾਲੀਆਂ ਸੀਟਾਂ ਆਉਂਦੀਆਂ ਸੀਗੀਆਂ ਉਹਨਾਂ ਦੇ ਉੱਤੇ ਅਤੇ ਜਦੋਂ ਜਿਵੇਂ ਜਿਵੇਂ ਮਤਲਬ ਥੋੜ੍ਹਾ ਮੇਰੀ ਪੇਟਿੰਗ ਵਿੱਚ ਸੁਧਾਰ ਹੋਇਆ ਮੇਰੇ ਪੇਂਟ ਕਰਨ ਦੇ ਤਰੀਕੇ ਵਿੱਚ ਸੁਧਾਰ ਹੋਇਆ ਮੇਰੀਆਂ ਕਮੀਆਂ ਪੇਸ਼ੀਆਂ ਸਹੀ ਹੋਣ ਲੱਗੀਆਂ ਤਾਂ ਹੌਲੀ ਹੌਲੀ ਜਿਹੜੀ ਮੈਂ ਪੇਂਟਿੰਗਸ ਹੈ ਆਪਣੀਆਂ ਉਹ ਕੈਨਵਸ ਦੇ ਉੱਤੇ ਸ਼ੁਰੂ ਕਰਨੀਆਂ ਸਟਾਰਟ ਕੀਤੀਆਂ ਪਹਿਲਾਂ ਚਾਰਟ ਪੇਪਰ ਦੇ ਉੱਤੇ ਕੀਤੀਆਂ ਫਿਰ ਕੈਨਵਸ ਦੇ ਉੱਤੇ ਕੀਤੀਆਂ ਅਤੇ ਜਿਵੇਂ ਜਿਵੇਂ ਮਤਲਬ ਵਧੀਆ ਹੋਈ ਗਈਆਂ ਪਹਿਲਾਂ ਪਹਿਲਾਂ ਜਿੱਦਾਂ ਛੋਟੇ ਕਲਰ ਹੁੰਦੇ ਸੀਗੇ ਜਿੱਦਾਂ ਆਪਾਂ ਪੈਨਸਲੀ ਕਲਰ ਹੋ ਗਏ ਮੋਮੀ ਕਲਰ ਹੋ ਗਏ ਆਪਾਂ ਪਹਿਲਾਂ ਇਹਨਾਂ ਦਾ ਯੂਜ਼ ਕਰਦੀ ਹੁੰਦੀ ਸੀਗੀ ਮੈਂ ਸਕੈਚ ਕਲਰਾਂ ਨੂੰ ਸਾਈਡ ਦੇ ਉੱਤੇ ਮਤਲਬ ਕਰਨੇ ਦੇ ਲਈ ਬਹੁਤ ਸਾਰੀ ਮਤਲਬ ਪੇਂਟਿੰਗਸ ਹੈ ਜੋ ਮੈਂ ਇਸ ਤਰ੍ਹਾਂ ਦੇ ਪੇਂਟ ਕੀਤੇ ਆ ਜਿਵੇਂ ਕਿ ਇਹ ਆਪਾਂ ਪੈਨਸਲ ਦੇ ਨਾਲ ਕੋਈ ਚੀਜ਼ ਨੂੰ ਆਪਾਂ ਡਰੋ ਕਰਦੇ ਹਾਂ ਆਪਾਂ ਬਣਾਉਂਦੇ ਆ ਪੈਨਸਲ ਦੇ ਨਾਲ ਐਵੇਂ ਦੇ ਵੀ ਪੇਂਟਿੰਗਸ ਮੈਂ ਕੈਨਵਸ ਦੇ ਉੱਤੇ ਬਣਾਈਆਂ ਹਨ ਅਤੇ ਪਹਿਲਾਂ ਪਹਿਲਾਂ ਮੈਂ ਪੇਂਟ ਚਾਰਟ ਪੇਪਰ ਦੇ ਉੱਤੇ ਡਰਾਇੰਗ ਸ਼ੀਟਸ ਦੇ ਉੱਤੇ ਚਾਰਟ ਪੇਪਰ ਦੇ ਉੱਤੇ ਫਿਰ ਕੈਨਵਸ ਦੇ ਉੱਤੇ ਕਲਰ ਮੈਂ ਬਹੁਤ ਸਾਰੇ ਯੂਜ ਕੀਤੇ ਹਨ ਜਿਵੇਂ ਕਿ ਪਹਿਲਾਂ ਮੋਮੀ ਤੁਹਾਨੂੰ ਮੈਂ ਦੱਸਿਆ ਹੀ ਹੈ ਅਤੇ ਹੁਣ ਵਾਟਰ ਕਲਰ ਕੈਨਵਸ ਦੇ ਵਿੱਚ ਮੈਂ ਜ਼ਿਆਦਾਤਰ ਕੈਨਵਸ ਦੇ ਉੱਤੇ ਮੈਂ ਪੇਂਟ ਕਰਨ ਦੀ ਵੀ ਜ਼ਿਆਦਾਤਰ ਮੈਂ ਵਾਟਰ ਕਲਰ ਯੂਜ ਕਰਦੀ ਹਾਂ ਕਿਉਂਕਿ ਵਾਟਰ ਕਲਰ ਵਧੀਆ ਮਤਲਬ ਕਲਰ ਕੈਨਵਸ ਨੂੰ ਵਧੀਆ ਇੱਕ ਮਤਲਬ ਦਿਖ ਪੇਸ਼ ਕਰਦਾ ਹੈ ਵਾਟਰ ਕਲਰ ਦੇ ਨਾਲ ਮੈਨੂੰ ਬਣਾਉਣਾ ਵਧੀਆ ਲੱਗਦਾ ਹੈ ਮਤਲਬ ਮੇਰਾ ਮਤਲਬ ਸਭ ਤੋਂ ਜ਼ਿਆਦਾ ਮਤਲਬ ਜੋ ਮੈਨੂੰ ਵਧੀਆ ਲੱਗਦਾ ਹੈ ਉਹ ਵਾਟਰ ਕਲਰ ਦੇ ਨਾਲ ਹੀ ਕੈਨਵਸ ਦੇ ਉੱਤੇ ਪੇਂਟਿੰਗ ਬਣਾਉਣਾ ਲੱਗਦਾ ਹੈ